ਪੰਜਾਬ ਵਿੱਚ ਨਿਊਜ਼ ਮੀਡੀਆ ਬਹੁਤ ਹੀ ਵੱਡਾ ਰੋਲ ਹੈ ਜੋ ਕਿ ਸਾਨੂੰ ਸਮਾਜਿਕ ਅਤੇ ਸਭਿਆਚਾਰ ਦੇ ਮੁੱਦਿਆਂ ਨੂੰ ਹਰ ਤਰ੍ਹਾਂ ਤੋਂ ਪੇਸ਼ ਕਰਦਾ ਰਹਿੰਦਾ ਹੈ ਅਗਰ ਪੰਜਾਬ 'ਚ ਸਮਾਜਿਕ ਜੋ ਸਾਨੂੰ ਸਰਕਾਰਾਂ ਵੱਲੋਂ ਸੁਵਿਧਾਵਾਂ ਮਿਲਦੀਆਂ ਨੇ ਉਨਾਂ 'ਚ ਜੋ ਵੀ ਸਾਨੂੰ ਨਹੀਂ ਮਿਲ ਪਾਉਂਦੀ ਉਸਦੇ ਬਾਰੇ 'ਚ ਵੀ ਉਹ ਅਲੱਗ ਅਲੱਗ ਤਰ੍ਹਾਂ ਦੀ ਡਿਬੇਟ ਕਰਦੇ ਰਹਿੰਦੇ ਨੇ ਜੋ ਕਿ ਐਕਸਪਰਟ ਨੂੰ ਬੁਲਾ ਕੇ ਉਹ ਸਾਰਿਆਂ 'ਚ ਇਹਦੇ ਵੀ ਡਿਸਕਸ਼ਨ ਕਰਦੇ ਰਹਿੰਦੇ ਨੇ ਸੱਭਿਆਚਾਰ ਮੁੱਦਿਆਂ 'ਤੇ ਵੀ ਸਾਨੂੰ ਬਹੁਤ ਸਾਰੀ ਗੱਲਾਂ ਮੀਡੀਆ ਥਰੂ ਪਤਾ ਚੱਲਦੀਆਂ ਨੇ ਅਤੇ ਸਰਕਾਰਾਂ ਵੱਲੋਂ ਜੋ ਨਈਂ ਨਈਂ ਸਕੀਮਾਂ ਲੋਂਚ ਹੁੰਦੀਆਂ ਨੇ ਉਹ ਜੋ ਸਮਾਜਿਕ ਤੌਰ 'ਤੇ ਹਰ ਇਕ ਵਿਅਕਤੀ ਨੂੰ ਪਤਾ ਚੱਲਣੀ ਚਾਹੀਦੀਆਂ ਹਨ ਉਹ ਵੀ ਸਾਨੂੰ ਮੀਡੀਆ ਥਰੂ ਹੀ ਕਈ ਵਾਰ ਪਤਾ ਚੱਲਦੀਆਂ ਨੇ ਉਹ ਸੱਭਿਆਚਾਰ ਦੇ ਵੀ ਪ੍ਰੋਗਰਾਮ ਮੀਡੀਆ ਕਰਵਾਉਂਦੀ ਰਹਿੰਦੀ ਹੈ ਜੋ ਕਿ ਜਿਹਦੇ ਬਾਰੇ ਇੱਕ ਨਿਊਜ਼ ਬਾਰੇ ਨਿਊਜ਼ ਦੇ ਦੁਆਰਾ ਸਾਰੇ ਜਨਤਾ ਵਿੱਚ ਉਹ ਸੱਭਿਆਚਾਰ ਦੇ ਪ੍ਰੋਗਰਾਮ ਅਤੇ ਸੱਭਿਆਚਾਰ ਕੀ ਹੁੰਦਾ ਹੈ ਉਹ ਸਾਰਾ ਪਤਾ ਲੱਗ ਜਾਵੇ